ਖਾਣਾ ਪਕਾਉਣ ਵੇਲੇ ਸਭ ਤੋਂ ਜ਼ਿਆਦਾ ਅਸੀਂ ਮਤਲਬ ਐਲਮੋਨੀਅਮ ਦੇ ਬਰਤਨ ਯੂਜ਼ ਕਰਦੇ ਹਾਂ ਜਿਵੇਂ ਕਿ ਸਿਲਵਰ ਜਿਹਨੂੰ ਬੋਲਦੇ ਹਨ ਸਿਲਵਰ ਦੇ ਬਰਤਨ ਯੂਜ਼ ਕਰਦੇ ਹਾਂ ਜ਼ਿਆਦਾ ਕਿ ਜਿਵੇਂ ਕੜਾਹੀ ਹੋ ਗਈ ਜਾਂ ਫਿਰ ਕੋਈ ਮਤਲਬ ਬਰਤਨ ਹੋ ਗਿਆ ਜਿਵੇਂ ਤਾਂਬੇ ਦੇ ਜੋ ਆਪਾਂ ਬਰਤਨ ਯੂਜ਼ ਕਰਦੇ ਹਨ ਜਿਹਦੇ ਵਿੱਚ ਅਸੀਂ ਮਤਲਬ ਆਪਣੇ ਮਤਲਬ ਸਬਜ਼ੀ ਬਣਾ ਸਕਦੇ ਹਾਂ ਖਾਣਾ ਖਾਣ ਵਾਸਤੇ ਜ਼ ਜ਼ਿਆਦਾਤਰ ਪੰਜਾਬੀ ਜਿਹੜੇ ਹੁੰਦੇ ਆ ਜਿਹੜੇ ਪਿੰਡਾਂ ਵਾਲੇ ਉਹ ਤਾਂ ਸਟੀਲ ਬਰਤਨ ਯੂਜ਼ ਕਰਦੇ ਹਨ ਖਾਣਾ ਖਾਣ ਵਾਸਤੇ ਸਟੀਲ ਦਾ ਚਮਚ ਹੋ ਗਿਆ ਸਟੀਲ ਦੀ ਕਟੋਰੀ ਹੋ ਗਈ ਸਟੀਲ ਦਾ ਥਾਲ ਹੋ ਗਿਆ ਉਹ ਤਾਂ ਖਾਣ ਵਾਸਤੇ ਵਰਤੇ ਜਾਂਦੇ ਸਨ ਜਿਹੜੇ ਹੁੰਦੇ ਨੇੇਗੇ ਇਹ ਪਕਾਉਣ ਵਾਸਤੇ ਇਹ ਜਿਹੜਾ ਹੈਗਾ ਸਿਲਵਰ ਦਾ ਧਾਤੂ ਵਰਤਿਆ ਜਾਂਦਾ ਹੈ ਜਿਹਦੇ ਵਿੱਚ ਕਿ ਇਹ ਖਾਣਾ ਵਧੀਆ ਪੱਕਦਾ ਹੈ ਵਧੀਆ ਤਰ੍ਹਾਂ ਰਿਝਦਾ ਹੈ ਜਿਹਦੇ ਵਿੱਚ ਵਧੀਆ ਤਰ੍ਹਾਂ ਮਤਲਬ ਅਪ ਖਾਣੇ ਨੂੰ ਆ ਆਪਣੇ ਅੰਦਰ ਅਜੋਰਬ ਕਰਦਾ ਹੈ ਇਹ ਜਿਹੜੀਆਂ ਹੁੰਦੇ ਬਰਤਨ ਹੁੰਦੇ ਸਨ ਜਿਹਦੇ ਨਾਲ ਕਿ ਅਸੀਂ ਮਤਲਬ ਖਾਣਾ ਸਾਡਾ ਵਧੀਆ ਪੱਕ ਜਾਂਦਾ ਜਿਵੇਂ ਰੋਟੀ ਵਾਸਤੇ ਤਾਂ ਇੱਕ ਲੋਹੇ ਦਾ ਤਵਾ ਜਿਹੜਾ ਉਹ ਵਰਤਿਆਂ ਜਾਂਦਾ ਹੈ ਜਿਹਦੇ ਉੱਤੇ ਲੋਹੇ ਰੋਟੀ ਜਿਹੜੀ ਹੁੰਦੀ ਹੈ ਵਧੀਆ ਸੇਕੀ ਜਾਂਦੀ ਹੈ ਵਧੀਆ ਪਕਾਇਆ ਜਾਂਦਾ ਹੈ ਜਿਹਦੇ ਨਾਲ ਵਧੀਆ ਰੋਟੀ ਫੁੱਲਦੀ ਹੈ ਅਤੇ ਸਾਡੀ ਰੋਟੀ ਵਧੀਆ ਪਕਾਈ ਜਾਂਦੀ ਹੈ ਅਤੇ ਜਿਹੜਾ ਇੱਕ ਹੁੰਦਾ ਹੈ ਕੇ ਮਤਲਬ ਇਹ ਜਿਹੜੇ ਕੜਾਹੀ ਹੁੰਦੀ ਹੈ ਇਹ ਇੱਕ ਸਿਲਵਰ ਦਾ ਧਾਤੂ ਹੁੰਦਾ ਭਰਤ ਦਾ ਧਾਤੂ ਹੁੰਦਾ ਜਿਹਦੇ ਨੂੰ ਜ਼ਹਾਜੀ ਲੋਹਾ ਵੀ ਕਿਹਾ ਜਾਂਦਾ ਇਹਦੇ ਵਿੱਚ ਜਿਹੜੇ ਕਿ ਇੱਕ ਸੁੱਕੀ ਸਬਜ਼ੀ ਜਿਵੇਂ ਕਿ ਗੋਭੀ ਗਾਭੀ ਵਗੈਰਾ ਬਣਾਉਣ ਦੇ ਕੰਮ ਆਉਂਦੀ ਹੈ ਇਹਦੇ ਵਿੱਚ ਇਹ ਵਾਲੇ ਬਰਤਨ ਯੂਜ਼ ਕੀਤੇ ਜਾਂਦੇ ਸਨ ਅਤੇ ਇਹਦੇ ਵਿੱਚ ਕਈ ਪ੍ਰਕਾਰ ਦੇ ਬਰਤਨ ਹੁੰਦੇ ਸਨ ਜਿਵੇਂ ਕਿ ਇੱਕ ਲੋਹੇ ਦੀ ਕੜਾਹੀ ਹੁੰਦੀ ਹੈ ਜਿਹਦੇ ਵਿੱਚ ਮਤਲਬ ਵਾਸਤੇ ਪੂੜੀਆਂ ਤਲਨ ਵਾਸਤੇ ਵੀ ਕੰਮ ਕੀਤਾ ਜਾਂਦਾ ਹੈ ਅਤੇ ਉਹ ਉਹਦੇ ਵਿੱਚ ਪੁਤ ਪੂੜੀਆਂ ਤਲੀਆਂ ਜਾਂਦੀਆਂ ਸਨ ਜਿਹਦੇ ਵਿੱਚ ਅਸੀਂ ਮਤਲਬ ਆਪਣੇ ਖਾਣੇ ਨੂੰ ਪਕਾ ਸਕਦੇ ਹਾਂ ਵਧੀਆ ਕਹਿਣ ਦਾ ਭਾਵ ਹੈ ਕਿ ਵਧੀਆ ਬਰਤਨ ਯੂਜ਼ ਕਰਨਾ ਚਾਹੀਦਾ ਸਾਫ਼ ਬਰਤਨ ਯੂਜ਼ ਕਰਨਾ ਚਾਹੀਦਾ ਜਿਹਦੇ ਵਿੱਚ ਸਾਡੀ ਸਿਹਤ ਸਹੀ ਰਹੇ ਖਾਣਾ ਵਧੀਆ ਪੱਕੇ ਅਤੇ ਅਸੀਂ ਵਧੀਆ ਤੰਦਰੁਸਤ ਬਣੇ ਰਹੀਏ